ਮੈਂ ਲਿਖਣ ਦੀ ਭਾਸ਼ਾ ਦੇ ਵਿੱਚ ਪੰਜਾਬੀ ਨੂੰ ਹੀ ਲਿਖਣ ਵਿੱਚ ਪਸੰਦ ਕਰਨਾ ਚਾਹੂੰਗਾ ਕਿਉਂਕਿ ਮੇਰੀ ਮਾਤ ਭਾਸ਼ਾ ਵੀ ਪੰਜਾਬੀ ਹੈ ਸਾਡੇ ਘਰ ਦਾ ਪੂਰਾ ਮਾਹੌਲ ਹੀ ਪੰਜਾਬ ਦਾ ਹੈ ਮੇਰੇ ਜੰਮ ਪਲ ਔਰ ਮੇਰੇ ਆਲੇ ਦੁਆਲੇ ਦਾ ਸਾਰਾ ਜੋ ਸਮਾਜਿਕ ਮਾਹੌਲ ਹੈ ਉਹ ਵੀ ਪੰਜਾਬੀ ਹੈ ਕਿਉਂਕਿ ਪੰਜਾਬੀ ਦੇ ਵਿੱਚ ਹਰ ਚੀਜ਼ ਸਾਡਾ ਸਾਰਾ ਪੰਜਾਬੀ ਕਲਚਰ ਹੈ ਮੇਰਾ ਸਕੂਲ ਦੇ ਵਿੱਚ ਜੋ ਮੀਡੀਅਮ ਸੀ ਉਹ ਵੀ ਪੰਜਾਬੀ ਸੀ ਇਸ ਲਈ ਪੰਜਾਬੀ ਵਿੱਚ ਆਪਣੇ ਦਿਲ ਦੇ ਪ੍ਰਗਟਾਵੇ ਆਪਣੀ ਕਹਾਣੀਆਂ ਨੂੰ ਸੁਣਾਉਣ ਦੇ ਲਈ ਮੈਂ ਹਰ ਇੱਕ ਨੂੰ ਆਸਾਨੀ ਨਾਲ ਪ੍ਰਭਾਵਿਤ ਕਰ ਸਕਦਾ ਹਾਂ ਅਤੇ ਪੰਜਾਬੀ ਨੂੰ ਵੀ ਆਪਣੇ ਪਹਿਲ ਦਿੰਦਾ ਹਹਾਂ